ਭਾਰਤ ਵਿੱਚ ਵੈਸੇ ਤਾਂ ਬਹੁਤ ਹੀ ਵੱਖ ਵੱਖ ਤਰੀਕੇ ਦੇ ਡਾਂਸ ਕੀਤੇ ਜਾਂਦੇ ਹਨ ਪੂਰੇ ਭਾਰਤ ਵਿੱਚ ਜੇ ਆਪਾਂ ਉੱਤਰ ਭਾਰਤ ਦੀ ਗੱਲ ਕਰੀਏ ਤਾਂ ਉੱਥੇ ਭੰਗੜਾ ਅਤੇ ਗਿੱਧਾ ਬਹੁਤ ਹੀ ਉਤਸ਼ਾਹਿਤ ਤਰੀਕੇ ਨਾਲ ਕੀਤਾ ਜਾਂਦਾ ਹੈ ਇਹ ਉਹ ਵਾਲੇ ਜਗ੍ਹਾ ਹਨ ਜਿੱਥੇ ਪੰਜਾਬ ਦਿੱਲੀ ਚੰਡੀਗੜ੍ਹ ਹਰਿਆਣਾ ਵਰਗੇ ਛੇਤਰ ਆਉਂਦੇ ਹਨ ਅਤੇ ਜੇ ਆਪਾਂ ਸਾਊਥ ਭਾਰਤ ਦੀ ਗੱਲ ਕਰੀਏ ਤਾਂ ਉੱਥੇ ਕੱਥਕ ਕਲੀ ਭਾਰਤਨਾਟਿਅਮ ਕੁਚੀਪੁੜੀ ਵਰਗੇ ਡਾਂਸ ਬਹੁਤ ਹੀ ਜ਼ਿਆਦਾ ਅਤੇ ਉਤਸ਼ਾਹਿਤ ਤਰੀਕੇ ਨਾਲ਼ ਕੀਤੇ ਜਾਂਦੇ ਹਨ ਸਾਡੇ ਭਾਰਤ ਵਿੱਚ ਇਸ ਤੋਂ ਇਲਾਵਾ ਹੋਰ ਵੀ ਵੱਖ ਵੱਖ ਤਰੀਕੇ ਦੇ ਅਲੱਗ ਅਲੱਗ ਖੇਤਰ ਦੇ ਹਿਸਾਬ ਨਾਲ ਜਿਹੜੇ ਡਾਂਸ ਹੈ ਉਹ ਪੇਸ਼ ਕੀਤੇ ਜਾਂਦੇ ਹਨ ਜਿਵੇਂ ਜੇ ਆਪਾਂ ਵਿੱਚ ਭਾਰਤ ਦੀ ਗੱਲ ਕਰੀਏ ਤਾਂ ਉੱਥੇ ਗੁਜਰਾਤ ਵਿੱਚ ਗਰਬਾ ਨਾਮ ਦਾ ਇੱਕ ਜਿਹੜਾ ਡਾਂਸ ਹੈ ਉਹ ਪੇਸ਼ ਕੀਤਾ ਜਾਂਦਾ ਹੈ ਅਤੇ ਇਹਨਾਂ ਵਿੱਚੋਂ ਹੀ ਇੱਕ ਬਹੁਤ ਹੀ ਮਸ਼ਹੂਰ ਕਲਾਕਾਰ ਹਨ ਉਹਨਾਂ ਦਾ ਨਾਮ ਹੈ ਰੈਮੋ ਡਿਸਊਜਾ ਵੈਸੇ ਤਾਂ ਬਹੁਤ ਹੀ ਅਲੱਗ ਅਲੱਗ ਖੇਤਰ ਵਿੱਚ ਅਲੱਗ ਅਲੱਗ ਪ੍ਰਸਿੱਧ ਕਲਾਕਾਰ ਇੱਥੇ ਹੈ ਅਤੇ ਰੈਮੋ ਡਿਸਊਜਾ ਜਿਹੜੇ ਹੈ ਉਹਨਾਂ ਨੇ ਆਪਣਾ ਜਿਹੜਾ ਡਾਂਸ ਦਾ ਕਰੀਅਰ ਹੈ ਉਹ ਫੋਲਕ ਅਤੇ ਕਲਾਸਿਕ ਤੋਂ ਸਟਾਰਟ ਕੀਤਾ ਸੀ ਇਸ ਤੋਂ ਇਲਾਵਾ ਇਹਨਾਂ ਨੇ ਪੂਰੇ ਭਾਰਤ ਦਾ ਜਿਹੜਾ ਡਾਂਸ ਸਟੈਪ ਹੈ ਇਹਨਾਂ ਨੇ ਕੀਤਾ ਸੀ